ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਟਰਾਂਸਪੋਰਟ ਏਜੰਸੀ ਤੋਂ ਬੋਲਦੇ ਹੋ ਹਾਂਜੀ ਸਰ ਸਰ ਇੱਕ ਕੱਲ੍ਹ ਸਾਡੇ ਇੱਧਰ ਸੋਸਾਇਟੀ ਵੱਲ ਸਫਾਈ ਵਾਲੇ ਆਏ ਸੀ ਸਫਾਈ ਕਰਨ ਲਈ ਕਿਉਂਕਿ ਸਰ ਹੁਣ ਤੁਹਾਨੂੰ ਪਤਾ ਹੀ ਹੈ ਕਰੋਨਾ ਦਾ ਟਾਈਮ ਚੱਲ ਰਿਹਾ ਠੀਕ ਹੈ ਅਤੇ ਕਰੋਨਾ ਦੇ ਵਿੱਚ ਉਹਨਾਂ ਨੇ ਜੋ ਸਫਾਈ ਕਰਮਚਾਰੀ ਸੀ ਡਰਾਇਵਰ ਸੀ ਉਹਨਾਂ ਨੇ ਕੋਈ ਮਾਸਕ ਨਹੀਂ ਪਾਇਆ ਅਤੇ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਦੀਆਂ ਸੀਟਾਂ ਸੀਗੀਆਂ ਕੈਬਸ ਵਾਲੀ ਕੈਬ ਦੀ ਸੀਟਸ ਸੀਗੀਆਂ ਉਹ ਸਾਰੀਆਂ ਗੰਦੀਆਂ ਹੋ ਰਹੀਆਂ ਸੀ ਸਫਾਈ ਬਿਲਕੁਲ ਵੀ ਨਹੀਂ ਸੀ ਡਰਾਈਵਰ ਨੇ ਮਾਸਕ ਨਹੀਂ ਪਾਇਆ ਮਾਸਕ ਬਹੁਤ ਅੱਜ ਦੇ ਟਾਈਮ ਦੇ ਵਿੱਚ ਮਾਸਕ ਬਹੁਤ ਜ਼ਰੂਰੀ ਹੈਗਾ ਕਿਉਂਕਿ ਇਹਦੇ ਨਾਲ ਕੀ ਆ ਆਲੇ ਦੁਆਲੇ ਜਿਹੜੇ ਉਹਨਾਂ ਦੇ ਨਾਲ ਵਾਲੇ ਲੋਕ ਨੇ ਉਹਨਾਂ ਨੂੰ ਵੀ ਥੋੜ੍ਹੀ ਦਿੱਕਤ ਆਉਂਦੀ ਹੈ ਕਰੋਨਾ ਦੇ ਟਾਈਮ ਦੇ ਵਿੱਚ ਮਾਸਕ ਪਾਉਣਾ ਜ਼ਰੂਰੀ ਹੈ ਅਤੇ ਜਿਹੜੀ ਸੀਟਸ ਨੇ ਉਹ ਬਹੁਤ ਬੇਕਾਰ ਸੀਗੀਆ ਜਦੋਂ ਟਰੈਵਲ ਕੀਤਾ ਟਰੈਵਲ ਕਰਨ ਵੇਲੇ ਵੀ ਬਹੁਤ ਦਿੱਕਤ ਆਈ ਐਨੀ ਗੰਦੀ ਸਮੈਲ ਆ ਰਹੀ ਸੀ ਸੀਟਾਂ ਵੀ ਪ੍ਰੋਪਰ ਨਹੀਂ ਸੀਗੀਆ ਬੈਠਣ ਦੇ ਵਿੱਚ ਵੀ ਦਿੱਕਤ ਆ ਰਹੀ ਸੀ ਕੋਈ ਸੀ ਪ੍ਰੋਪਰ ਅਰੇਜ਼ਮੈਂਟ ਨਹੀਂ ਸੀਗਾ ਹਾਂਜੀ ਨਹੀਂ ਸਫਾਈ ਵਧੀਆ ਕਰ ਗਏ ਸਰ ਸਫਾਈ ਦਾ ਕੋਈ ਸਾਨੂੰ ਪ੍ਰੋਬਲਮ ਨਹੀਂ ਬਟ ਜਿਹੜਾ ਉਹਨਾਂ ਦਾ ਬਿਹੇਵੀਅਰ ਸੀ ਉਹਨਾਂ ਦੇ ਸਫਾਈ ਮਾਸਕ ਵਗੈਰਾ ਉਹ ਨਹੀਂ ਸੀ ਪਾਏ ਕਿਉਂਕਿ ਕੋਲ ਬੱਚੇ ਰਹਿੰਦੇ ਨੇ ਠੀਕ ਹੈ ਬੱਚਿਆਂ ਕਰਕੇ ਸਾਨੂੰ ਦਿੱਕਤ ਆਉਂਦੀ ਵੀ ਹਾਂ ਬੱਚੇ ਕਰੋਨਾ ਕਰੁਨਾ ਹੋ ਜਾਵੇ ਹਾਂਜੀ ਅਤੇ ਜਿਹੜੀ ਹੁਣ ਕੈਬ ਦੇ ਵਿੱਚ ਅਸੀਂ ਟਰੈਵਲ ਕੀਤਾ ਉਹ ਕੈਬ ਵੀ ਬਹੁਤ ਸਾਨੂੰ ਦਿੱਕਤ ਦੇ ਰਹੀ ਸੀ ਸੀਟਸ ਹਿੱਲਦੀਆਂ ਸੀ ਕੋਈ ਪ੍ਰੋਪਰ ਸੀ ਬੈਗ ਵਗੈਰਾ ਰੱਖਣ ਵਾਸਤੇ ਜਗ੍ਹਾ ਨਹੀਂ ਸੀ ਸੀਟ ਸੀਟਸ ਸਾਫ ਨਹੀਂ ਸੀਗੀਆਂ ਇੰਨੀ ਗੰਦੀ ਸਮੈਲ ਸੀ ਕੋਈ ਪ੍ਰੋਪਰ ਅਰੇਜ਼ਮੈਂਟ ਨਹੀਂ ਸੀ

ਉਹਦੇ ਸ਼ੀਸ਼ੇ ਵੀ ਟੁੱਟੇ ਹੋਏ ਸੀਗੇ ਸ਼ੀਸ਼ਿਆਂ ਦੇ ਵਿੱਚ ਹਵਾ ਬਾਹਰ ਕ੍ਰੋਸ ਨਹੀਂ ਸੀ ਹੁੰਦੀ ਔਰ ਜਿਹੜਾ ਉਹਦਾ ਦਰਵਾਜ਼ਾ ਸੀ ਕੈਬ ਦਾ ਉਹ ਵੀ ਹਿਲਦਾ ਸੀ ਕੋਈ ਸੇਫਟੀ ਨਹੀਂ ਸੀ ਬੱਚੇ ਹੱਥ ਵਗੈਰਾ ਵੀ ਪਾ ਸਕਦੇ ਸੀ ਵਿੱਚ ਬੱਚਿਆਂ ਨੂੰ ਵੀ ਦਿੱਕਤ ਆ ਰਹੀ ਸੀ ਬੱਚੇ ਸਫੋਕੇਸ਼ਨ ਫੀਲ ਕਰ ਰਹੇ ਸੀ ਹਾਂਜੀ ਤਾਂ ਕਰਕੇ ਤੁਹਾਨੂੰ ਕਹਿ ਰਹੇ ਹਾਂ ਵੀ ਜਿਹੜਾ ਵੀ ਕੋਈ ਡਰਾਈਵਰ ਆਉਂਦਾ ਉਹਨੂੰ ਕਹੋ ਵੀ ਜਦੋਂ ਕੋਈ ਟਰੈਵਲ ਵਾਸਤੇ ਕੈਬ ਭੇਜਦੇ ਨੇ ਤਾਂ ਉਹਦਾ ਪ੍ਰੋਪਰ ਅਰੇਜ਼ਮੈਂਟ ਹੋਵੇ ਬੈਠਣ ਦਾ ਪਾਣੀ ਵਗੈਰਾ ਰੱਖਣ ਦਾ ਬੈਗ ਵਗੈਰਾ ਰੱਖਣ ਦਾ ਕੋਈ ਵੀ ਵਧੀਆ ਹਰ ਇੱਕ ਸਿਸਟਮ ਹੈ ਜਿਹੜਾ ਉਹ ਵਧੀਆ ਹੋਵੇ ਹਾਂਜੀ ਹਾਂਜੀ ਹਾਂਜੀ ਟਰੈਵਲ ਕੋਈ ਹੋਰ ਕੋਈ ਦਿੱਕਤ ਨਹੀਂ ਓਕੇ ਜੀ ਓਕੇ ਥੈਂਕ ਯੂ